ਹੈਲੋ ਭਰਾਵਾਂ ਦੇ ਢਾਬੇ ਤੋਂ ਬੋਲਦੇ ਹੋ ਮੈਨੂੰ ਤੁਹਾਡੀ ਰੇਡਿੰਗ ਲਿਸਟ ਭੇਜ ਦਿਓ ਅਸੀਂ ਵੀ ਹਰ ਰੋਜ਼ ਖਾਣਾ ਮੰਗਵਾਉਣਾ ਚਾਹੁੰਦੇ ਹਾਂ ਤੁਹਾਡੇ ਢਾਬੇ ਤੋਂ ਤੁਹਾਡੀ ਲਿਸਟ ਆ ਗਈ ਹੈ ਤੁਹਾਡੇ ਰੇਟ ਤਾਂ ਬਹੁਤ ਹੀ ਜਾਇਜ਼ ਹੈ ਰੈਸਟੋਰੈਂਟ ਲਿਸਟ ਵਿੱਚ ਕੇਸਰ ਦੇ ਢਾਬੇ ਤੋਂ ਬੋਲਦੇ ਹੋ ਮੈਨੂੰ ਤੁਹਾਡੀ ਲਿਸਟ ਚਾਹੀਦੀ ਸੀ ਮੈਂ ਸੁਣਿਆ ਤੁਹਾਡੇ ਖਾਣਾ ਬਹੁਤ ਵਧੀਆ ਹੈ ਹਾਂਜੀ ਮੈਨੂੰ ਤੁਹਾਡੀ ਲਿਸਟ ਆ ਗਈ ਹੈ ਪਰ ਮੇਰਾ ਦੋਸਤ ਕਹਿੰਦਾ ਹੈ ਕਿ ਕੇਸਰ ਨਾਲੋਂ ਭਰਾਵਾਂ ਦੇ ਢਾਬੇ ਦੀ ਚੀਜ਼ ਬਹੁਤ ਜ਼ਿਆਦਾ ਸਵਾਦ ਹੁੰਦੀ ਹੈ ਲੋਕ ਬੜੇ ਮਨ ਨਾਲ ਉਸਦੇ ਢਾਬੇ ਦੀ ਵਡਿਆਈ ਕਰਦੇ ਹਾਂ ਇਸ ਕਰਕੇ ਮੈਂ ਵੀ ਭਰਾਵਾਂ ਦੇ ਢਾਬੇ ਤੋਂ ਭੋਜਨ ਮੰਗਵਾਉਣਾ ਚਾਹੁੰਦੀ ਹਾਂ ਧੰਨਵਾਦ